ਹੈਲੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜ ਹਾਂਜੀ ਬੇਟਾ ਹਾਂਜੀ ਠੀਕ ਹੈ ਹਾਂਜੀ ਬੇਟਾ ਦੱਸੋ ਕਿਹੜੀ ਕੰਪਨੀ ਦਾ ਲੈਣਾ ਤੁਸੀਂ ਹਾਂ ਠੀਕ ਹੈ ਸਾਡੇ ਕੋਲ ਤਾਂ ਬਹੁਤ ਸਾਰੀਆਂ ਕੰਪਨੀਆਂ ਤੁਸੀਂ ਦੱਸੋ ਕਿਹੜੀ ਕੰਪਨੀ ਦਾ ਲੈਣਾ ਅਸੀਂ ਉਸ ਕੰਪਨੀ ਨੂੰ ਕਢਾ ਦਿੰਦੇ ਹਾਂ ਤੁਹਾਨੂੰ ਅਸੀਂ ਤੁਹਾਨੂੰ ਡਿਸਕਾਊਂਟ ਕਰਕੇ ਹਾਂ ਹੋਕਿੰਗ ਦਾ ਦੇ ਦਿੰਦੇ ਹਾਂ ਹੋਕਿੰਗ ਦਾ ਲੈ ਲਓ ਉਹਦੇ 'ਚ ਡਿਸਕਾਊਂਟ ਵੀ ਬਹੁਤ ਜ਼ਿਆਦਾ ਹੈਗਾ ਵਾ ਬੇਟਾ ਉਹ ਦੇਖ ਲੈਣਾ ਤੁਸੀਂ ਠੀਕ ਹੈ ਹਾਂ ਹਾਂਜੀ ਦੇਖ ਲਓ ਜੇ ਹੈ ਤੁਸੀਂ ਦੇਖ ਲਓ ਤੁਸੀਂ ਹਾਂ ਗੱਲ ਸੁਣ ਇਹਨਾਂ ਦੀ ਤਾਂ ਵੈਸੇ ਹੈਗੀ ਹੈ ਟਵੈਲਵ ਸੌ ਦੀ ਹੈ ਮਤਲਬ ਬਾਰ੍ਹਾਂ ਕੁ ਸੌ ਤੋਂ ਸ਼ੁਰੂ ਹੈਗੀ ਹੈ ਹੁਣ ਤੁਹਾਡੀ ਮਰਜ਼ੀ ਮੁਤਾਬਕ ਤੁਸੀਂ ਆਓਗੇ ਤੁਹਾਡੇ ਨਾਲ ਆਪਾਂ ਥੋੜ੍ਹਾ ਡਿਸਕਾਊਂਟ ਕਰ ਲਵਾਂਗੇ ਠੀਕ ਹੈ ਹਾਂ ਜਿੰਨੇ ਲੀਟਰ ਦਾ ਤੁਸੀਂ ਕਹੋਗੇ ਉਹ ਅਸੀਂ ਦੇ ਦੇਵਾਂਗੇ ਹਾਂਜੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਸੌ ਦੋ ਸੌ ਰੁਪਈਆ ਡਿਸਕਾਊਂਟ ਵੀ ਕਰ ਦਊਂਗੀ ਚਲੋ ਜੇ ਜ਼ਿਆਦਾ ਕਰਨਾ ਨਾ ਤਾਂ ਜ਼ਿਆਦਾ ਵੀ ਕਰ ਦਾਂਗੇ ਅਗਰ ਤੁਸੀਂ ਆਓ ਤਾਂ ਸਹੀ ਜ਼ਰੂਰ ਆਪਣਾ ਮੌਕਾ ਦਿਓ ਚੀਜ਼ ਖਰੀਦਣ ਦਾ ਹਾਂਜੀ ਠੀਕ ਕੋਈ ਗੱਲ ਨਹੀਂ ਹਾਂ ਬਿੱਲ ਨਾਲ ਦੇਵਾਂਗੇ ਹਾਂਜੀ ਸਾਡੇ ਕੋਲ ਸਾਰਾ ਕਰੋਕਰੀ ਦਾ ਸਮਾਨ ਹੈ ਜੋ ਤੁਸੀਂ ਲੈਣਾ ਹੈ ਜੋ ਵੀ ਘਰ ਦੇ ਵਿੱਚ ਚੱਲਦਾ ਚੁੱਲ੍ਹੇ ਵਗੈਰਾ ਲਗਾਉਣਾ ਵੈਂ ਕੋਈ ਚੀਜ਼ ਜਿਹੜੀ ਵੀ ਤੁਹਾਨੂੰ ਜ਼ਰੂਰਤ ਹੈ ਉਹ ਤੁਹਾਨੂੰ ਸਭ ਚੀਜ਼ਾਂ ਮਿਲ ਸਕਦੀਆਂ ਹਨ ਹਾਂਜੀ ਠੀਕ ਹੈ ਉਹ ਵੀ ਮਿਲ ਜਾਵੇਗਾ ਹਾਂ ਉਹ ਵੀ ਮਿਲ ਜਾਵੇਗਾ ਬੇਟਾ ਤੁਸੀਂ ਆਉਣਾ ਤਾਂ ਦੇਖ ਲੈਣਾ ਮਤਲਬ ਉਹ ਘੱਟ ਤੋਂ ਘੱਟ ਤੁਹਾਨੂੰ ਰੇਟ ਲਾਵਾਂਗੇ ਅਸੀਂ ਤੁਹਾਨੂੰ ਡਿਸਕਾਊਂਟ ਕਰ ਦਾਂਗੇ ਐਸੀ ਗੱਲ ਨਹੀਂ ਕੋਈ ਹੈਗੀ ਹਾਂ ਤੁਸੀਂ ਸਵੇਰੇ ਸਾਢੇ ਦਸ ਵਜੇ ਤੋਂ ਉੱਦਾਂ ਸ਼ੋਪ ਖੁੱਲ੍ਹਦੀ ਹੈ ਸ਼ਾਮੀ ਛੇ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਸਵੇਰੇ ਤੁਸੀਂ ਦਸ ਵਜੇ ਤੇ ਆਓ ਜ਼ਰੂਰ ਮੌਕਾ ਦਿਓ ਠੀਕ ਹੈ ਹਾਂ ਜ਼ਰੂਰ ਮੌਕਾ ਦਿਓ ਜੀ ਓਕੇ ਓਕੇ ਬਾਏ